ਸੋਲ੍ਹਾਂ ਜਨਵਰੀ ਦੋ ਹਜ਼ਾਰ ਦੋ ਤੇਈ ਅਕਤੂਬਰ ਦੋ ਹਜ਼ਾਰ ਛੇ ਇੱਕ ਜਨਵਰੀ ਉੱਨੀ ਸੌ ਨੜਿਨਵੇਂ ਪੰਜ ਅਪ੍ਰੈਲ ਅਠਾਰ੍ਹਾਂ ਸੌ ਛਿਹੱਤਰ ਸੱਤ ਦਸੰਬਰ ਉੱਨੀ ਸੌ ਪਚਾਨਵੇਂ ਚੌਦ੍ਹਾਂ ਨਵੰਬਰ ਅਠਾਰ੍ਹਾਂ ਸੌ ਇਕਹੱਤਰ